ਹਾਂ ਮੈਂ ਆਪਣੀ ਨਨਾਣ ਦੀ ਬੇਟੀ ਲਈ ਇੱਕ ਲਹਿੰਗਾ ਚੋਲੀ ਤਿਆਰ ਕੀਤਾ ਸੀਗਾ ਉਹਦਾ ਮੈਨੂੰ ਬਹੁਤ ਵਧੀਆ ਅਨੁਭਵ ਹੋਇਆ ਮੈਂ ਉਹਨੂੰ ਬਹੁਤ ਤਰੀਕੇ ਨਾਲ ਕਢਾਈ ਕਢੁਈ ਕੀਤੀ ਉਹਨਾਂ 'ਤੇ ਲੈਸਾਂ ਲਗਾਈਆਂ ਹੈਂਡ ਵਰਕ ਕੀਤਾ ਉਹਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕੀਤਾ ਔਰ ਉਹਦਾ ਡਿਜ਼ਾਇਨ ਦੇਖ ਕੇ ਫੁਲਕਾਰੀ ਦਾ ਡਿਜ਼ਾਈਨ ਵੀ ਪਾਇਆ ਉਹਦੇ ਉੱਤੇ ਉਹਦਾ ਡਿਜ਼ਾਇਨ ਦੇਖ ਕੇ ਉਹਦੀਆਂ ਫਰੈਂਡਸ ਵੀ ਕਹਿੰਦੀਆਂ ਆਂਟੀ ਸਾਡੇ ਵੀ ਡਿਜਾਇਨ ਹੁਣ ਨਾ ਇਹੀ ਡਿਜ਼ਾਇਨ ਨਾਲ ਸਾਡੇ ਵੀ ਲਹਿੰਗੇ ਚੋਲੀਆਂ ਤਿਆਰ ਕਰ ਦੋ ਸਾਨੂੰ ਵੀ ਇੱਦਾਂ ਦੇ ਡਿਜ਼ਾਈਨ ਦੇ ਲਹਿੰਗੇ ਚੋਲੀਆਂ ਚਾਹੀਦੀਆਂ ਹਨ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਕਸਟਮਰ ਆ ਗਏ ਮੇਰੇ ਮੈਨੂੰ ਬਹੁਤ ਜ਼ਿਆਦਾ ਪ੍ਰਸ਼ੰਸਾ ਮਿਲੀ ਔਰ ਮੇਰਾ ਇਸ ਤਰ੍ਹਾਂ ਉਹ ਵੀ ਡਿਜ਼ਾਇਨ ਨੂੰ ਬਹੁਤ ਫੇਮਸ ਹੋਇਆ ਔਰ ਮੇਰੇ ਕਸਟਮਰ ਵੀ ਬਹੁਤ ਬਣ ਗਏ ਇਹਦੇ ਨਾਲ